ਹਾਂ ਮੈਂ ਘੋੜਸਵਾਰੀ ਕਰਦੇ ਸਮੇਂ ਜਾਨਲੇਵਾ ਸਥਿਤੀ ਦਾ ਸਾਹਮਣਾ ਕਰਦਾ ਹਾਂ ਪਰ ਮੈਂ ਜ਼ਿਆਦਾਤਰ ਘੋੜਸਵਾਰੀ ਖੁੱਲ੍ਹੇ ਰਸਤਿਆਂ ਵਿੱਚ ਜਾਂ ਖੁੱਲ੍ਹੇ ਮੈਦਾਨ ਵਿੱਚ ਕਰਦਾ ਹਾਂ ਪਰ ਕਈ ਵਾਰ ਘੋੜਸਵਾਰੀ ਕਰਦੇ ਸਮੇਂ ਕਿਸੇ ਵੀ ਸਾਧਨ ਤੋਂ ਜਾਂ ਕਿਸੇ ਵੀ ਆਦਮੀ ਤੋਂ ਘੋੜਾ ਡਰ ਜਾਂਦਾ ਹੈ ਜਿਸ ਦੇ ਕਾਰਨ ਉਹ ਬੇਕਾਬੂ ਹੋ ਜਾਂਦਾ ਹੈ ਅਤੇ ਉਹ ਕੰਡਿਆਲੀਆਂ ਤਾਰਾਂ ਜੋ ਕਿ ਖੇਤਾਂ ਦੇ ਆਸ ਪਾਸ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਵੱਲ ਹੋ ਜਾਂਦਾ ਹੈ ਜਿਸ ਕਾਰਨ ਘੋੜੇ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ ਘੋੜਸਵਾਰ ਦੀ ਵੀ ਜਾਨ ਨੂੰ ਖਤਰਾ ਹੁੰਦਾ ਹੈ ਕਈ ਵਾਰ ਰਸਤੇ ਵਿੱਚ ਘੋੜਸਵਾਰੀ ਕਰਦੇ ਸਮੇਂ ਘੋੜਾ ਕਿਸੇ ਸਾਧਨ ਤੋਂ ਜਾਂ ਮਸ਼ੀਨਰੀ ਤੋਂ ਡਰ ਜਾਂਦਾ ਹੈ ਜਿਸ ਦੇ ਕਾਰਨ ਉਹ ਬੇਕਾਬੂ ਹੋ ਜਾਂਦਾ ਹੈ ਜਾਂ ਉਸ ਮਸ਼ੀਨਰੀ ਵੱਲ ਹੋ ਜਾਂਦਾ ਹੈ ਜਿਸ ਦੇ ਕਾਰਨ ਐਕਸੀਡੈਂਟ ਹੋ ਜਾਂਦਾ ਹੈ ਅਤੇ ਘੋੜਸਵਾਰ ਅਤੇ ਘੋੜੇ ਨੂੰ ਚੋਟ ਪਹੁੰਚਣ ਦਾ ਖਤਰਾ ਹੁੰਦਾ ਹੈ ਇਸ ਤੋਂ ਇਲਾਵਾ ਘੋੜਸਵਾਰ ਕਈ ਵਾਰ ਘੋੜਾ ਦਾ ਮਨ ਨਹੀਂ ਹੁੰਦਾ ਘੋੜਸਵਾਰੀ ਕਰਵਾਉਣ ਦਾ ਅਤੇ ਘੋੜਾ ਬੇਕਾਬੂ ਹੋ ਜਾਂਦਾ ਹੈ ਅਤੇ ਉਹ ਘੋੜਸਵਾਰ ਨੂੰ ਵੱਢਣ ਨੂੰ ਵੀ ਪੈ ਜਾਂਦਾ ਹੈ ਜਿਸ ਦੇ ਕਾਰਨ ਘੋੜਸਵਾਰ ਨੂੰ ਵੀ ਬਹੁਤ ਚੋਟਾਂ ਆ ਸਕਦੀਆਂ ਹਨ ਇਸ ਤੋਂ ਇਲਾਵਾ ਘੋੜਸਵਾਰ ਕਈ ਵਾਰ ਘੋੜਸਵਾਰੀ ਕਰਦੇ ਸਮੇਂ ਡਿੱਗ ਵੀ ਜਾਂਦਾ ਹੈ ਜਿਸ ਦੇ ਕਾਰਨ ਉਸਦੀ ਲੱਤ ਬਾਂਹ ਟੁੱਟਣ ਦਾ ਖਤਰਾ ਹੁੰਦਾ ਹੈ